ਸਿੱਖਿਆ ਪ੍ਰਣਾਲੀ ਦੇ ਵਿੱਚ ਪਿਛਲੇ ਕੁਛ ਸਮੇਂ ਤੋਂ ਬਹੁਤ ਜ਼ਿਆਦਾ ਬਦਲਾਅ ਆਏ ਹਨ ਪਿਛਲੇ ਸਮਿਆਂ ਦੇ ਵਿੱਚ ਜੋ ਉੱਚ ਸਿੱਖਿਆ ਸੀ ਉਹ ਪੈਸੇ ਵਾਲੇ ਲੋਕਾਂ ਦੇ ਲਈ ਹੀ ਸੰਭਵ ਹੁੰਦੀ ਸੀ ਪਰ ਹੁਣ ਇਸ ਸਿੱਖਿਆ ਪ੍ਰਣਾਲੀ ਦੇ ਵਿੱਚ ਕਈ ਤਰ੍ਹਾਂ ਦੇ ਵੱਡੇ ਬਦਲਾਅ ਆਏ ਹਨ ਜਿੱਦਾਂ ਕਿ ਰਾਈਟ ਟੂ ਐਜੂਕੇਸ਼ਨ ਤਾਂ ਇਸ ਦੇ ਅਨੁਸਾਰ ਹਰ ਇਨਸਾਨ ਨੂੰ ਵਿੱਦਿਆ ਗ੍ਰਹਿਣ ਕਰਨ ਦਾ ਹੱਕ ਹੈ ਤਾਂ ਭਾਵੇਂ ਉਸ ਦੇ ਕੋਲ ਪੈਸਾ ਹੈ ਜਾਂ ਨਹੀਂ ਹੈ ਤਾਂ ਉਸਦੇ ਲਈ ਅਲੱਗ ਅਲੱਗ ਤਰ੍ਹਾਂ ਦੀਆਂ ਸਕੀਮਾਂ ਜੋ ਹਨ ਉਹ ਸਰਕਾਰ ਦੁਆਰਾ ਸਮੇਂ ਸਮੇਂ 'ਤੇ ਚਲਾਈਆਂ ਜਾਂਦੀਆਂ ਹਨ ਇਸ ਦੇ ਵਿੱਚ ਜਿੱਦਾਂ ਇੱਕ ਬਹੁਤ ਅਹਿਮ ਸਕੀਮ ਹੈ ਈ ਡਬਲਯੂ ਐੱਸ ਇਕਨੋਮਿਕਲ ਵੀਕਰ ਸੈਕਸ਼ਨ ਸਕੀਮ ਜਿਸਦੇ ਵਿੱਚ ਜਿਹਨਾ ਵਿਦਿਆਰਥੀਆਂ ਦੇ ਕੋਲ ਪੈਸਾ ਘੱਟ ਹੁੰਦਾ ਹੈ ਜੇ ਜਾਂ ਆਮਦਨ ਦੇ ਸਾਧਨ ਨਹੀਂ ਹੁੰਦੇ ਤਾਂ ਉਹਨਾਂ ਨੂੰ ਫੀਸ ਜੋ ਹੈ ਘੱਟ ਹੁੰਦੀ ਹੈ ਜਾਂ ਮਾਫ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਸਿੰਗਲ ਗਰਲ ਚਾਇਲਡ ਸਕੀਮ ਜਿੱਦਾਂ ਹੈ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਕੀਮਾਂ ਹਨ ਜੋ ਕਿ ਅੱਜ ਹਰ ਵਿਦਿਆਰਥੀ ਨੂੰ ਵਿੱਦਿਆ ਗ੍ਰਹਿਣ ਕਰਨ ਦੇ ਲਈ ਉਤਸ਼ਾਹਿਤ ਕਰ ਰਹੀਆਂ ਹਨ